ਹਰ ਫੋਟੋ ਦੇ ਪਿੱਛੇ ਕੋਈ ਨਾ ਕੋਈ ਯਾਦ ਲੁਕੀ ਹੁੰਦੀ ਹੈ ਅਤੇ ਅਸੀਂ ਤਸਵੀਰਾਂ ਖਿੱਚਦੇ ਹੀ ਇਸ ਲਈ ਹਾਂ ਕਿ ਸਾਡੀ ਯਾਦ ਸਾਂਭੀ ਜਾ ਸਕੇ ਅਤੇ ਤਸਵੀਰ ਖਿੱਚਣ ਦਾ ਮੰਤਵ ਹੀ ਇਹ ਹੈ ਕਿ ਉਹ ਸਾਡੀ ਯਾਦ ਦੇ ਵਿੱਚ ਵਸੀ ਰਹੇ ਮੈਂ ਵੀ ਇਊਂ ਹੀ ਕਰਦਾ ਹਾਂ ਜਦੋਂ ਕੋਈ ਦ੍ਰਿਸ਼ ਇਵੇਂ ਦਾ ਦਿਖਦਾ ਹੈ ਜੋ ਬਹੁਤ ਮਨ ਨੂੰ ਭਾਉਂਦਾ ਹੈ ਜਾਂ ਕੋਈ ਖੁਸ਼ੀ ਦਾ ਪਲ਼ ਹੁੰਦਾ ਹੈ ਤਾਂ ਮੈਂ ਉਸ ਨੂੰ ਆਪਣੇ ਕੈਮਰੇ ਦੇ ਵਿੱਚ ਕੈਦ ਕਰ ਲੈਂਦਾ ਹਾਂ